ਹਾਂਜੀ ਮੇਰੇ ਸਕੂਲ ਵਿੱਚ ਇੱਕ ਲਾਈਬ੍ਰੇਰੀ ਹੈ ਆਮ ਤੌਰ 'ਤੇ ਪ੍ਰਾਈਮਰੀ ਸਕੂਲਾਂ ਵਿੱਚ ਲਾਈਬ੍ਰੇਰੀ ਨਹੀਂ ਹੁੰਦੀ ਪਰ ਮੈਨੂੰ ਮੇਰਾ ਸ਼ੌਕ ਸੀਗਾ ਕਿਤਾਬਾਂ ਦਾ ਤਾਂ ਸੋ ਮੈਂ ਆਪਣੀ ਇੱਕ ਸਪੈਸ਼ਲ ਲਾਇਬ੍ਰੇਰੀ ਸਕੂਲ ਦੇ ਵਿੱਚ ਬਣਾਈ ਹੈਗੀ ਹੈ ਬਹੁਤ ਸਾਰੀਆਂ ਕਿਤਾਬਾਂ ਆ ਅਸ ਅਸਲ ਵਿੱਚ ਪੰਜਾਬ ਸਰਕਾਰ ਦਾ ਵਧੀਆ ਉਪਰਾਲਾ ਕਿ ਹਰ ਸਾਲ ਸਾਨੂੰ ਇੱਕ ਪੰਜ ਹਜ਼ਾਰ ਦੀ ਗ੍ਰਾਂਟ ਆਉਂਦੀ ਹੈ ਕਿਤਾਬਾਂ ਖਰੀਦਣ ਲਈ ਨਵੀਆਂ ਕਿਤਾਬਾਂ ਖਰੀਦਣ ਲਈ ਬੱਚਿਆਂ ਦੇ ਵਿੱਚ ਪੜ੍ਹਨ ਦੀ ਰੁਚੀ ਵਿਕਸਿਤ ਕਰਨ ਲਈ ਸੋ ਇੱਕ ਲਿਸਟ ਵੀ ਆਉਂਦੀ ਉਹਨਾਂ ਵੱਲੋਂ ਵੀ ਕਿਤਾਬਾਂ ਕਿਹੜੀਆਂ ਬੱਚਿਆਂ ਦੇ ਜਿਹੜੇ ਲੈਵਲ ਦੀਆਂ ਉਹ ਸਾਨੂੰ ਸੁਜੈਸਟ ਵੀ ਕੀਤੀਆਂ ਜਾਂਦੀਆਂ ਕੁਛ ਮੈਂ ਆਪ ਚੂਜ਼ ਕਰਦੀ ਹਾਂ ਉਹ ਕਿਤਾਬਾਂ ਹੈ ਨਾ ਅਤੇ ਮੇਰੇ ਕੋਲ ਲਗਭਗ ਮੇਰੇ ਸਕੂਲ ਦੇ ਵਿੱਚ ਲਗਭਗ ਮੇਰੇ ਕੋਲ ਚਾਰ ਸੌ ਦੇ ਕਰੀਬ ਹੈਗੀਆਂ ਕਿਤਾਬਾਂ ਹੈ ਨਾ ਅਤੇ ਜੇ ਮੈਂ ਆਪਣੀ ਪਰਸਨਲ ਗੱਲ ਕਰਾਂ ਅਤੇ ਮੇਰੇ ਕੋਲ ਵੱਡੀ ਆਪਣੀ ਘਰ ਦੀ ਲਾਇਬਰੇਰੀ ਵਿੱਚ ਲਗਭਗ ਸੱਤ ਅੱਠ ਸੌ ਦੇ ਕਰੀਬ ਕਿਤਾਬਾਂ ਹੈਗੀਆਂ ਆ ਬਚਪਨ ਵਿੱਚ ਜਿਹੜੀਆਂ ਕਿਤਾਬਾਂ ਜਿਵੇਂ ਅਸੀਂ ਪੜ੍ਹਦੇ ਸੀ ਵਿਕਰਮ ਬੇਤੌਲ ਸੀ ਜਾਂ ਮੋਟੂ ਪਤਲੂ ਸੀ ਜਾਂ ਮੈਂ ਕੁਛ ਨਾਵਲ ਪੜ੍ਹੇ ਆ ਇੱਕ ਜਿਹੜਾ ਸਾਨੂੰ ਸਕੂਲ ਦੇ ਵਿੱਚ ਸਾਡੇ ਸਿਲੇਬਸ ਦੇ ਵਿੱਚ ਨਾਵਲ ਲੱਗਿਆ ਹੋਇਆ ਸੀਗਾ ਤੂਤਾਂ ਵਾਲਾ ਖੂਹ ਮਾਸ਼ਾ ਅੱਲ੍ਹਾ ਉਹੋ ਜਿਹਾ ਨਾਵਲ ਮੈਂ ਮੁੜ ਕੇ ਕਦੀ ਨਹੀਂ ਜ਼ਿੰਦਗੀ ਵਿੱਚ ਪੜ੍ਹਿਆ ਅਤੇ ਮੈਂ ਚਾਹੁੰਦੀ ਹਾਂ ਕਿ ਇਹ ਜਿਹਾ ਨਾਵਲ ਮੈਂ ਬੱਚਿਆਂ ਨੂੰ ਇੱਥੇ ਆਪਣੀ ਸਕੂਲ ਦੇ ਵਿੱਚ ਵੀ ਪੜ੍ਹਾਵਾਂ ਪਰ ਉਹ ਸ਼ਾਇਦ ਥੋੜ੍ਹਾ ਜਿਹਾ ਮੇਰੇ ਬੱਚਿਆਂ ਦੇ ਏਜ਼ ਗਰੁੱਪ ਤੋਂ ਥੋੜ੍ਹਾ ਵੱਡਾ ਆ ਜਦੋਂ ਇਹ ਨਾਈਨ ਟੈਂਨਥ ਵਿੱਚ ਆਉਣਗੇ ਤਾਂ ਉਹ ਆਈ ਥਿੰਕ ਉਦੋਂ ਇਹ ਸਮਝ ਸਕਦੇ ਆ ਉਹ ਇਹੋ ਜਿਹੇ ਨਾਵਲਸ ਨੂੰ ਬਹੁਤ ਸੋਹਣੇ ਨੋਵਲ ਹੈਗੇ ਆ ਨਾਨਕ ਸਿੰਘ ਦੇ ਨਾਵਲ ਮੈਨੂੰ ਬਹੁਤ ਪਸੰਦ ਹੈ ਸੋ ਕਈ ਹੋਰ ਜਿਵੇਂ ਬਚਪਨ 'ਚ ਮੈਂ ਪੜ੍ਹਦੀ ਰਹੀ ਹਾਂ ਚੀਜ਼ਾਂ ਜਨਰਲ ਨੌਲਜ ਦੀਆਂ ਕਿਤਾਬਾਂ ਵਗੈਰਾ ਜਾਂ ਅਖਬਾਰਾਂ ਵਗੈਰਾ ਹੈ ਨਾ ਸੋ ਅੱਜ ਕੱਲ੍ਹ ਜੋ ਚੀਜ਼ ਮੈਂ ਨੋਟ ਕਰ ਰਹੀ ਹਾਂ ਕਿ ਬੱਚਿਆਂ ਦੇ ਵਿੱਚ ਇਹ ਰੁਚੀ ਘੱਟ ਹੈ ਕਿਤਾਬਾਂ ਪੜ੍ਹਨ ਦੀ ਕਿਉਂਕਿ ਇਹਨਾਂ ਕੋਲ ਟੀ ਵੀ ਇੱਕ ਅਲਟਰਨੇਟ ਹੈਗਾ ਆ ਹੈ ਨਾ ਸੋ ਇਹ ਦੇਖਣਾ ਹੀ ਪਸੰਦ ਕਰਦੇ ਆ ਮੋਸਟਲੀ ਬੱਚੇ ਕਾਰਟੂਨ ਹੈ ਕਾਰਟੂਨ ਚੈਨਲਜ਼ ਕਿੰਨੇ ਹੀ ਮਤਲਬ ਅੱਜ ਕੱਲ੍ਹ ਚੱਲ ਰਹੇ ਹੈ ਸੋ ਬੱਚਿਆਂ ਦੇ ਵਿੱਚ ਇਹ ਰੁਚੀ ਘੱਟ ਰਹੀ ਹੈ ਇਸ ਰੁਚੀ ਨੂੰ ਹੀ ਵਿਕਸਿਤ ਕਰਨ ਲਈ ਮੈਂ ਸਕੂਲ ਦੇ ਵਿੱਚ ਸਪੈਸ਼ਲੀ ਇੱਕ ਲਾਇਬ੍ਰੇਰੀ ਰੂਮ ਬਣਾਇਆ ਸ ਸੋਸਾਇਟੀ ਦੀ ਮਦਦ ਨਾਲ਼ ਸੋ ਕਿਤਾਬਾਂ ਹੈਗੀਆਂ ਬੱਚੇ ਪੜ੍ਹਦੇ ਆ ਔਰ ਹੁਣ ਥੋੜ੍ਹੇ ਪ੍ਰੇਰਿਤ ਵੀ ਹੋ ਰਹੇ ਆ ਅਤੇ ਮੈਂ ਚਾਹੁੰਦੀ ਹਾਂ ਕਿ ਹਰ ਸਕੂਲ ਦੇ ਵਿੱਚ ਇਹ ਲਾਇਬ੍ਰੇਰੀਜ਼ ਹੋਣੀਆਂ ਚਾਹੀਦੀਆਂ ਆ ਔਰੰ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਵੱਲ ਹੀ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਕਿਉਂਕਿ ਸੋਸ਼ਲ ਮੀਡੀਆ ਇੰਨਾ ਇਫੈਕਟਿਵ ਨਹੀਂ ਹੈਗਾ ਬੱਚੇ ਉਹ ਤੋਂ ਗਲਤ ਵੀ ਸਿੱਖਦੇ ਹੈ ਸੋ ਕਿਤਾਬਾਂ ਜਿਹੜੀਆਂ ਬੱਚੇ ਦੀ ਲਾਈਫ ਦੇ ਵਿੱਚ ਹੋਣੀਆਂ ਕਿਤਾਬਾਂ ਦਾ ਰੋਲ ਬ ਜ਼ਰੂਰੀ ਹੈ ਅਤੇ ਲਾਈਬ੍ਰੇਰੀ ਵੱਲ ਸਪੈਸ਼ਲੀ ਧਿਆਨ ਦਿੱਤਾ ਜਾਣਾ ਚਾਹੀਦਾ ਆ